ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ ਬਣਾਈ ਰੱਖਣ ਲਈ ਹੇਠਲੇ ਲਿਖੇ ਕੰਮ ਕਰਨੇ ਬਹੁਤ ਜ਼ਰੂਰੀ ਹਨ ਜਿਵੇਂ ਕਿ ਉਹਨਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਆਪਣੀ ਬਿਮਾਰੀਆਂ ਤੋਂ ਬਚਣ ਵਾਸਤੇ ਟੀਕਾਕਰਨ ਵੀ ਕਰਨਾ ਚਾਹੀਦਾ ਹੈ ਹੈਲਥੀ ਚੰਗੀ ਡਾਇਟ ਲੈਣੀ ਚਾਹੀਦੀ ਹੈ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਅੰਦਰ ਬਿਮਾਰੀਆਂ ਨੂੰ ਲੜਨ ਦੀ ਸ਼ਕਤੀ ਵਧੀਆ ਬਣੀ ਰਹੇ ਅੱਜ ਕੱਲ੍ਹ ਮੱਛਰਾਂ ਵਾਲੀਆਂ ਬਿਮਾਰੀਆਂ ਬਹੁਤ ਵੱਧ ਜਾਂਦੀਆਂ ਹਨ ਜਦੋਂ ਬਾਰਿਸ਼ਾਂ ਵਗੈਰਾ ਹੁੰਦੀਆਂ ਹਨ ਉਹਨਾਂ ਤੋਂ ਬਚਣ ਵਾਸਤੇ ਉਹਨਾਂ ਨੂੰ ਮੱਛਰਾਂ ਨੂੰ ਮਾਰਨ ਵਾਲੇ ਉਪਾਅ ਵਰਤਣੇ ਚਾਹੀਦੇ ਹਨ ਤਾਂ ਕਿ ਉਹਨਾਂ ਨੂੰ ਕੋਈ ਡੇਂਗੂ ਮਲੇਰੀਆ ਵਰਗੀ ਬਿਮਾਰੀ ਨਾ ਹੋਵੇ ਤਾਂ ਨਾਲੇ ਉਹਨਾਂ ਨੂੰ ਸਿਹਤ ਵੀ ਅ ਆਪਣੀ ਚੰਗੀ ਕਰਨ ਵਾਸਤੇ ਜਿੰਮ ਜੂੰਮ ਜਾਣਾ ਜਿੰਮ ਵਗੈਰਾ ਅ ਅਖਾੜੇ ਵਗੈਰਾ ਜਾਣੇ ਚਾਹੀਦੇ ਹਨ ਤਾਂ ਕਿ ਉਹਨਾਂ ਸਿਹਤ ਚੰਗੀ ਰਹੇ ਸਰੀਰਕ ਤੌਰ 'ਤੇ ਸੈਕ ਸਾਈਕਲ ਵੀ ਚਲਾਉਣਾ ਚਾਹੀਦਾ ਹੈ ਦੌੜ ਲਗਾਉਣੀ ਚਾਹੀਦੀ ਹੈ ਜੋਗਿੰਗ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਬੋਡੀ 'ਤੇ ਫ ਮਾਸ ਨਾ ਜਮ੍ਹਾ ਹੋਵੇ ਤਾਂ ਕਿ ਉਹਨਾਂ ਨੂੰ ਸਾਹ ਚੜਨ ਦੀ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਧੰਨਵਾਦ ਜੀ